ਸਤਿ ਸ਼੍ਰੀ ਅਕਾਲ ਭਰਾ ਹੋਰ ਸੁਣਾਓ ਕੀ ਹਾਲ ਹੈ ਬਸ ਕੋਈ ਨਹੀਂ ਵੀਰੇ ਵਧੀਆ ਜਿਹੇ ਤੁਸੀਂ ਨਾ ਬੂਟਸ ਦਿਖਾ ਦਿਉ ਸ਼ੂਜ਼ ਦਿਖਾ ਦਿਉ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਗਿਆ ਮੈਂ ਕਿਹਾ ਚਲੋ ਭਰਾ ਕੋਲੋਂ ਵਧੀਆ ਜਿਹੇ ਸ਼ੂਜ਼ ਵਗੈਰਾ ਲੈ ਆਈਏ ਬਸ ਭਰਾ ਕੰਮਾਂ ਕਾਰਾਂ 'ਚ ਬੀਜੀ ਤੁਹਾਨੂੰ ਪਤਾ ਹੀ ਹੈ ਫਿਰ ਹੁਣ ਜਿੰਮੇਵਾਰੀਆਂ ਸਿਰ 'ਤੇ ਪੈ ਗਈਆਂ ਵਿਆਹ ਹੋ ਗਿਆ ਬੱਚੇ ਹੋ ਗਏ ਫਿਰ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਫਿਰ ਉਹਨਾਂ ਨੂੰ ਖਵਾਉਣਾ ਪਿਆਉਣਾ ਫਿਰ ਕੋਈ ਕੰਮ ਕਾਰ ਕਰਨਾ ਪੈਂਦਾ ਫਿਰ ਇਸ ਕਰਕੇ ਜਿੰਮੇਵਾਰੀਆਂ ਵੱਧ ਗਈਆਂ ਬਸ ਕੋਈ ਪਾਰਟੀ ਵਾਸਤੇ ਆਪਾਂ ਨੂੰ ਕੋਈ ਬੈਲੀ ਵਗੈਰਾ ਵਧੀਆ ਜਿਹੀ ਦਿਖਾ ਦਿਉ ਹਾਂਜੀ ਹਾਂਜੀ ਫਾਰਮਲ ਦੇ ਨਾਲ ਵਧੀਆ ਜਿਹੀ ਕੋਈ ਬੈਲੀ ਦਿਖਾ ਦਿਉ ਹਾਂ ਪਹਿਲਾਂ ਬੈਲੀ ਦਿਖਾ ਦਿਓ ਫਿਰ ਆਪਾਂ ਸਪੋਰਟ ਸ਼ੂਜ਼ ਦੀ ਗੱਲ ਫਿਰ ਕਰਾਂਗੇ ਪਹਿਲਾਂ ਬੈਲੀ ਦਿਖਾ ਦਓ ਹਾਂ ਹਾਂਜੀ ਨੌਂ ਨੰਬਰ ਵੀਰੇ ਨਹੀਂ ਵੀਰੇ ਥੋੜ੍ਹੇ ਟਾਇਟ ਆ ਰਿਹਾ ਹਾਂਜੀ ਆਹ ਸਹੀ ਥੋੜ੍ਹਾ ਜਿਹਾ ਇਹਦੇ 'ਚ ਨਾ ਥੋੜ੍ਹੀ ਜਿਹੀ ਕੋਈ ਹਾਈ ਕਵਾਲਟੀ ਆਲਾ ਦਿਖਾਓ ਵੀਰੇ ਇਹ ਠੀਕ ਹੈ ਆਹ ਥੋੜ੍ਹਾ ਜਿਹਾ ਵੀਰੇ ਕਲਰ ਇਹਦਾ ਥੋੜ੍ਹਾ ਜਿਹਾ ਹੋਰ ਦਿਖਾ ਦਿਉ ਮਾੜਾ ਜਿਹਾ ਬਲੈਕ ਜਿਹੇ 'ਚ ਹਾਂਜੀ ਬਲੈਕ ਦਿਖਾ ਦਿਉ ਹਾਂ ਅੱਛਾ ਆਪਣੇ ਇਹਦੀ ਗਰੰਟੀ ਗਰੁੰਟੀ ਵੀਰੇ ਕਿੰਨੇ ਟਾਈਮ ਦੀ ਅੱਛਾ ਜੀ ਠੀਕ ਹੈ ਜੀ ਆਪਣਾ ਕਿੰਨਾ ਰੇਟ ਰੂਟ ਕਿੰਨਾ ਇਹਦਾ ਜੀ ਨਹੀਂ ਜਾਇਜ਼ ਜਾਇਜ਼ ਕਰੋ ਭਰਾਵਾਂ ਵਾਲੀ ਗੱਲ ਕਰੋ ਫਿਰ ਵੀ ਤੁਹਾਡੇ ਕੋਲ ਇੰਨੀਆਂ ਦੁਕਾਨਾਂ ਛੱਡ ਕੇ ਆਏ ਹਾਂ

ਅੱਛਾ ਜੀ ਚਲੋ ਠੀਕ ਹੈ ਆਪਣਾ ਕੋਈ ਹਾਂ ਹਾਂ ਬੱਚੇ ਵਾਸਤੇ ਦਿਖਾ ਦਿਉ ਇਹਨਾਂ ਨੂੰ ਆਪਣੇ ਇਹਦੇ ਕੋਈ ਛੋਟ ਸ਼ੂਜ ਸਪੋਰਟਸ ਸ਼ੂਜ਼ ਦਿਖਾ ਦਿਉ ਬੱਚੇ ਵਾਸਤੇ ਨਹੀਂ ਆਪਾਂ ਨੂੰ ਸਿੰਪਲ ਹੀ ਦਿਖਾ ਦਿਉ ਲਾਈਟਾਂ ਵਾਲਿਆਂ ਸਾਈਜ ਨਹੀਂ ਲੱਗਣਗੇ ਆਪਾਂ ਨੂੰ ਸਿੰਪਲ ਦਿਖਾ ਦਿਉ ਕੋਈ ਲੇਸੀਜ਼ ਵਾਲੇ ਜਿਹੜੇ ਸਪੋਰਟਸ ਸ਼ੂਜ਼ ਹੁੰਦੇ ਨੇ ਹਾਂਜੀ ਹਾਂਜੀ

ਇਹ ਅੰਦਰੋਂ ਨਿੱਘੇ ਹੋਣਗੇ ਨਾ ਹਾਂ ਹੁਣ ਸਰਦੀਆਂ ਦਾ ਸੀਜ਼ਨ ਆ ਰਿਹਾ ਅਤੇ ਮੈਂ ਕਿਹਾ ਚਲੋ ਨਿੱਘੇ ਲੈ ਚੱਲੀਏ ਮਾੜਾ ਜਿਹਾ ਬੱਚਿਆਂ ਵਾਸਤੇ ਤੁਹਾਨੂੰ ਪਤਾ ਹੀ ਹੈ ਫਿਰ ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਇਹਨਾਂ ਦਾ ਕੀ ਪ੍ਰਾਈਸ ਵਗੈਰਾ ਬੱਚੇ ਦੇ ਸ਼ੂਜ਼ ਦਾ ਅੱਛਾ ਠੀਕ ਠੀਕ ਠੀਕ ਅਤੇ ਬੱਚੇ ਹਾਂ ਉਹ ਤਾਂ ਚਲੇ ਗਏ ਠੀਕ ਚਲੋ ਆ ਬੱਚੇ ਦੇ ਕਰ ਦਿਉ ਪੈਕ ਆਪਣੇ ਸ਼ੂਜ ਬਸ ਆਪਣਾ ਟੋਟਲ ਬਣਾ ਦਿਓ ਕਿੰਨਾ ਬਣਿਆ ਆਪਣਾ ਠੀਕ ਆ ਪੰਦਰ੍ਹਾਂ ਸੌ ਰੁਪਈਆ ਫੜੋ ਜੀ ਆਪਾਂ ਆਹ ਵੀਹ ਰੁਪਏ ਦੇ ਦਿਉ ਸਾਨੂੰ